ਪੁਸਤਕਾਂ ਤਾਂ ਭਾਵੇਂ ਮੈਂ ਬਹੁਤ ਸਾਰੀਆਂ ਪੜ੍ਹੀਆਂ ਪਰ ਮੇਰੇ ਦੁਆਰਾ ਪੜ੍ਹੀ ਗਈ ਆਖਰੀ ਕਿਤਾਬ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਡੂੰਘੀਆਂ ਸਿਖਰਾਂ ਪੁਸਤਕ ਦਾ ਨਾਮ ਹੈਗਾ ਇਹ ਪੁਸਤਕ ਵਾਰਤਕ ਦੇ ਲੇਖਾਂ ਦੀ ਪੁਸਤਕ ਹੈ ਅਤੇ ਬਹੁਤ ਹੀ ਚੰਗੇ ਵਿਚਾਰਾਂ ਨਾਲ ਭਰਪੂਰ ਹੈ ਜਿਹਨੂੰ ਕਿ ਅਸੀਂ ਜ਼ਿੰਦਗੀ ਦੇ ਵਿੱਚ ਵੀ ਅਪਣਾ ਸਕਦੇ ਹਾਂ ਇਹਦੇ ਵਿੱਚ ਵੱਖ ਵੱਖ ਜਿਹੜੇ ਜ਼ਿੰਦਗੀ ਦੇ ਨਾਲ ਸੰਬੰਧਿਤ ਲੇਖ ਨੇ ਜਿਵੇਂ ਸਿਦਕ ਸਿਰੜ ਅਤੇ ਦ੍ਰਿੜਤਾ ਲੇਖ ਹੈ ਇਸ ਤਰ੍ਹਾਂ ਦੇ ਹੋਰ ਵੀ ਮਨੁੱਖੀ ਜ਼ਿੰਦਗੀ ਦੇ ਵਿੱਚ ਪ੍ਰਭਾਵ ਪਾਉਣ ਵਾਲੇ ਬਹੁਤ ਸਾਰੇ ਲੇਖ ਸ਼ਾਮਿਲ ਨੇ ਇਹਨਾਂ ਲੇਖਾਂ ਦੇ ਰਾਹੀਂ ਇਨਸਾਨ ਬਹੁਤ ਕੁਛ ਸਿੱਖ ਲੈਂਦਾ ਹੈ ਇਹ ਬੜੇ ਪ੍ਰਭਾਵਸ਼ਾਲੀ ਜਿਹੜੀ ਛਾਪ ਛੱਡਦੇ ਨੇ ਇਹਨਾਂ ਨੂੰ ਪੜ੍ਹ ਕੇ ਕਦੇ ਵੀ ਤੁਹਾਨੂੰ ਅਕੇਵਾਂ ਮਹਿਸੂਸ ਨਹੀਂ ਹੁੰਦਾ ਮੈਂ ਇਸ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਬਹੁਤ ਵਧੀਆ ਚੰਗਾ ਮਹਿਸੂਸ ਕੀਤਾ ਨਾ ਹੀ ਮੈਨੂੰ ਕੋਈ ਅਕੇਵਾਂ ਮਹਿਸੂਸ ਹੋਇਆ ਅਤੇ ਨਾ ਹੀ ਮੈਨੂੰ ਇਹ ਲੱਗਿਆ ਕਿ ਮੈਂ ਇਸ ਕਿਤਾਬ ਨੂੰ ਪੜ੍ਹ ਕੇ ਕੋਈ ਆਪਣਾ ਸਮਾਂ ਹੈ ਜਿਹੜਾ ਨਸ਼ਟ ਕੀਤਾ ਹੈ ਬਲਕਿ ਮੈਨੂੰ ਇਹ ਲੱਗਿਆ ਕਿ ਇਸ ਪੁਸਤਕ ਦੇ ਵਿੱਚ ਜਿਹੜੀ ਇੰਨੀ ਗਿਆਨਵਰਤਕ ਜਾਣਕਾਰੀ ਸੀਗੀ ਉਹ ਮੇਰੇ ਤੱਕ ਅੱਪੜੀ ਹੈ ਉਹ ਮੈਂ ਮੈਂ ਬਹੁਤ ਕੁਛ ਸਿੱਖਿਆ ਉਹਦੇ ਰਾਹੀਂ ਅਤੇ ਜ਼ਿੰਦਗੀ ਵਿੱਚ ਮਨੁੱਖ ਨੂੰ ਅੱਗੇ ਵਧਣ ਦੇ ਲਈ ਜੋ ਵੀ ਵੱਖ ਵੱਖ ਤਰ੍ਹਾਂ ਦੇ ਜਿਹੜੇ ਟਿਪਸ ਨੇ ਉਹ ਇਸ ਕਿਤਾਬ ਦੇ ਵਿੱਚੋਂ ਅਸੀਂ ਪ੍ਰਾਪਤ ਕਰ ਸਕਦੇ ਹਾਂ ਮੈਨੂੰ ਇਹ ਕਿਤਾਬ ਪੜ੍ਹਨ ਤੋਂ ਬਾਅਦ ਮਨ ਹੈ ਜਿਹੜਾ ਖੁਸ਼ ਖੁਸ਼ ਮਹਿਸੂਸ ਹੋਣ ਲੱਗਿਆ ਅਤੇ ਕੰਮ ਕਰਨ ਦੇ ਵਿੱਚ ਇੱਕ ਨਵੀਂ ਜਿਹੜੀ ਤਾਕਤ ਹੈ ਉਹ ਵੀ ਮੈਨੂੰ ਮਹਿਸੂਸ ਹੋਈ ਹੈ ਕਿ ਮੈਂ ਆਪਣਾ ਕੰਮ ਹੈ ਜਿਹੜਾ ਉਤਸ਼ਾਹ ਨਾਲ ਕਰ ਸਕਦੀ ਹਾਂ ਅਤੇ ਕਦੇ ਵੀ ਇਸ ਕਿਤਾਬ ਨੂੰ ਜੇ ਕਿਸੇ ਨੇ ਹੋਰ ਵੀ ਪੜ੍ਹਨਾ ਹੋਵੇ ਤਾਂ ਉਸ ਨੂੰ ਵੀ ਇਸ ਤੋਂ ਬਹੁਤ ਵਧੀਆ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ ਅਤੇ ਇਹ ਜਾਣਕਾਰੀ ਪ੍ਰਾਪਤ ਕਰਕੇ ਅਸੀਂ ਉੱਚੀਆਂ ਬੁਲੰਦੀਆਂ 'ਤੇ ਪਹੁੰਚ ਸਕਦੇ ਹਾਂ